ਜੇਕਰ ਤੁਸੀਂ ਕਿਸੇ ਰੈਸਟੋਰੈਂਟ ਵਿੱਚ ਸਾਹ ਲੈਣ ਵਿੱਚ ਗੰਭੀਰ ਸਮੱਸਿਆਵਾਂ ਜਾਂ ਸਾਹ ਘੁਟਣ ਦਾ ਅਨੁਭਵ ਕਰਦੇ ਹੋਏ ਦੇਖਦੇ ਹੋ ਤਾਂ ਤੁਰੰਤ ਅਤੇ ਸ਼ਾਂਤੀ ਨਾਲ ਕੰਮ ਕਰੋ ਪਹਿਲਾਂ ਇਹ ਸੁਨਿਸ਼ਚਿਤ ਕਰੋ ਕਿ ਵਿਅਕਤੀ ਇੱਕ ਸੁਰੱਖਿਅਤ ਅਤੇ ਆਰਾਮਦਾਇਕ ਸਥਿਤੀ ਵਿੱਚ ਹੈ ਤਰਜੀਹੀ ਤੌਰ 'ਤੇ ਸਾਹ ਲੈਣ ਦੀ ਸਹੂਲਤ ਲਈ ਸਿੱਧਾ ਬੈਠਣਾ ਤੁਰੰਤ ਡਾਕਟਰੀ ਸਹਾਇਤਾ ਦੀ ਬੇਨਤੀ ਕਰਨ ਲਈ ਸਥਾਨਕ ਐਮਰਜੈਂਸੀ ਨੰਬਰ ਇੱਕ ਸੌ ਅੱਠ ਡਾਇਲ ਕਰਕੇ ਬਿਨਾਂ ਕਿਸੇ ਦੇਰੀ ਦੇ ਐਮਰਜੈਂਸੀ ਸੇਵਾਵਾਂ ਨੂੰ ਕਾਲ ਕਰੋ ਮਦਦ ਦੀ ਉਡੀਕ ਕਰਦੇ ਹੋਏ ਵਿਅਕਤੀ ਨੂੰ ਪੁੱਛੋ ਕਿ ਕੀ ਉਹਨਾਂ ਨੂੰ ਸਾਹ ਸੰਬੰਧੀ ਕੋਈ ਜਾਣਿਆ ਪਹਿਚਾਣਿਆ ਹਾਲਾਤ ਹਨ ਜਾਂ ਦਵਾਈ ਲੈ ਕੇ ਜਾਓ ਜਿਵੇਂ ਕਿ ਇਨਹੈਲਰ ਅਤੇ ਲੋੜ ਪੈਣ 'ਤੇ ਇਸਦੀ ਵਰਤੋਂ ਕਰਨ ਵਿੱਚ ਉਹਨਾਂ ਦੀ ਮਦਦ ਕਰੋ ਉਹਨਾਂ ਨੂੰ ਹੌਲੀ ਡੂੰਘੇ ਸਾਹ ਲੈਣ ਲਈ ਉਤਸ਼ਾਹਿਤ ਕਰੋ ਅਤੇ ਉਹਨਾਂ ਨੂੰ ਜਿੰਨਾ ਸੰਭਵ ਹੋ ਸਕੇ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ ਕਿਉਂਕਿ ਘਬਰਾਹਟ ਸਾਹ ਲੈਣ ਵਿੱਚ ਮੁਸ਼ਕਿਲਾਂ ਨੂੰ ਵਧਾ ਸਕਦੀ ਹੈ ਜੇਕਰ ਵਿਅਕਤੀ ਬੇਹੋਸ਼ ਹੋ ਜਾਂਦਾ ਹੈ ਤਾਂ ਉਹਨਾਂ ਦੀ ਸਾਹ ਨਾਲੀ ਨੂੰ ਸਾਫ਼ ਰੱਖਣ ਲਈ ਉਹਨਾਂ ਨੂੰ ਹੌਲੀ ਹੌਲੀ ਰਿਕਵਰੀ ਪੁਜੀਸ਼ਨ ਵਿੱਚ ਰੱਖੋ ਅਤੇ ਜੇਕਰ ਤੁਸੀਂ ਸਿਖਲਾਈ ਪ੍ਰਾਪਤ ਹੋ ਤਾਂ ਸੀ ਪੀ ਆਰ ਸ਼ੁਰੂ ਕਰੋ ਇਹ ਸੁਨਿਸ਼ਚਿਤ ਕਰੋ ਕੇ ਉਹਨਾਂ ਦੀ ਸਾਹ ਨਾਲੀ ਖੁੱਲ੍ਹੀ ਰਹੇ ਅਤੇ ਤੁਸੀਂ ਛਾਤੀ ਦੇ ਸਕੁੰਚਣ ਕਰਦੇ ਰਹੋ ਉਹਨਾਂ ਦੀ ਸਥਿਤੀ ਦੀ ਲਗਾਤਾਰ ਨਿਗਰਾਨੀ ਕਰੋ ਅਤੇ ਐਮਰਜੈਂਸੀ ਜਵਾਬ ਦੇਣ ਵਾਲਿਆਂ ਨੂੰ ਉਹਨਾਂ ਦੇ ਪਹੁੰਚਣ 'ਤੇ ਵੱਧ ਤੋਂ ਵੱਧ ਜਾਣਕਾਰੀ ਪ੍ਰਦਾਨ ਕਰੋ ਜਿਸ ਵਿੱਚ ਕੋਈ ਵੀ ਸੰਬੰਧਿਤ ਡਾਕਟਰੀ ਇਤਿਹਾਸ ਜਾਂ ਤੁਹਾਡੇ ਦੁਆਰਾ ਕੀਤੇ ਗਏ ਨਿਰੀਖਣਾਂ ਸਮੇਤ